ਪੰਜਾਬ ਵਿੱਚ ਵਾਪਰਕ ਖੇਤਰ ਸਥਾਨਕ ਆਰਥਿਕਤਾ ਜਾਂ ਵਿਕਾਸ ਵਿੱਚ ਕਿਵੇਂ ਯੋਗਦਾਨ ਪਾਉਂਦਾ ਹੈ ਸੰਕੇਤ ਨੌਕਰੀਆਂ ਮਾਲੀਆਂ ਨਿਵੇਸ਼ ਵਾਧਾ ਹਿੰਡ ਕ੍ਰੀਏਟ ਨਿਊ ਮਾਰਕੀਟਸ ਅਡੈਪਟਟੈਬੈਲਟੀ ਕਰੀਏਟ ਨਿਊ ਬਿਜ਼ਨਸਸ